ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਤੁਹਾਡਾ ਕੀ ਹਾਲ ਹੈ ਤੁਸੀਂ ਤੁਸੀਂ ਦਿਲਜੀਤ ਦੀ ਨਵੀਂ ਫਿਲਮ ਦੇਖੀ ਭੈਣ ਜਿਹੜੀ ਨਵੀਂ ਆਈ ਨਹੀਂ ਗੁੱਡ ਨਿਊਜ਼ ਉਹ ਤੁਸੀਂ ਦੇਖੀ ਹੀ ਨਹੀਂ ਤੁਸੀਂ ਦੇਖਿਆ ਨਹੀਂ ਕਿੱਦਾਂ ਉਹ ਪਹਿਲਾਂ ਪੰਜਾਬੀ ਸਿੰਗਰ ਸੀਗਾ ਉਹ ਪੰਜਾਬੀ ਫਿਲਮਾਂ ਕੱਢਦਾ ਸੀ ਹੁਣ ਦੇਖੋ ਬੋਲੀਵੁੱਡ ਦੇ ਵਿੱਚ ਉਹਦੀ ਗੁੱਡ ਨਿਊਜ਼ ਫਿਲਮ ਆਈ ਹੈ ਇੰਨੀ ਵਧੀਆ ਫਿਲਮ ਆਈ ਹੈ ਸਾਡੇ ਪੰਜਾਬ ਪੰਜਾਬ ਦਾ ਮੁੰਡਾ ਬੋਲੀਵੁੱਡ ਦੇ ਵਿੱਚ ਪਹੁੰਚ ਆ ਗਿਆ ਕਿੱਦਾਂ ਨਹੀਂ ਜੀ ਸਹੀ ਗੱਲ ਹੈ ਹੁਣ ਹਾਂ ਸਹੀ ਗੱਲ ਹੈ ਹੁਣ ਕਪਿਲ ਨੂੰ ਹੀ ਲੈ ਲਾ ਤੂੰ ਕਪਿਲ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਉਹ ਕਮੇਡੀ ਵਿੱਚ ਵੀ ਉਹਦੀ ਹੁਣ ਕੋਈ ਟੱਕਰ ਹੀ ਨਹੀਂ ਕਰ ਪਾ ਰਿਹਾ ਹੈ ਨਾ

ਹਾਂ ਹਾਂ ਸਹੀ ਗੱਲ ਹੈ